ਹਾਂਜੀ ਅਸੀਂ ਸ਼ਹੀਦ ਬਗਤ ਸਿੰਘ ਨਗਰ ਵਿੱਚ ਹੀ ਰਹਿੰਦੇ ਹਾਂ ਇੱਥੇ ਸਾਰੀ ਰੀਤੁ ਬਹੁਤ ਵਧੀਆ ਨਿਕਲਦੀ ਹੈ ਗਰਮੀ ਦੀ ਬ ਬਸੰਤ ਦੀ ਚਾਹੇ ਬਾਰਿਸ਼ ਵਾਲੀ ਸਾਰੀ ਵਧੀਆ ਹੈ ਲੇਕਿਨ ਇੱਥੇ ਨਾ ਪਹਾੜੀ ਇਲਾਕਾ ਹੈ ਨਾ ਇਸ ਕਰਕੇ ਇੱਥੇ ਥੋੜ੍ਹਾ ਬਹੁਤ ਜ਼ਿਆਦਾ ਹੜ੍ਹ ਬਹੁਤ ਆਉਂਦਾ ਹੈ ਜੋ ਕਿ ਲੋਕਾਂ ਦੇ ਘਰਾਂ ਵਿੱਚ ਘੁਸ ਜਾਂਦਾ ਹੈ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ ਹੋਰ ਤਾਂ ਮੌਸਮ ਸਾਰੇ ਸਹੀ ਹੈ ਜੋ ਗਰਮੀ ਵਾਲੇ ਹੈ ਉਹ ਵੀ ਬਹੁਤ ਵਧੀਆ ਹੈ ਇੱਥੇ ਹੋਰ ਜਿਹੜੇ ਠੰਡੀ ਵਾਲੇ ਹੈ ਸਰਦੀਆਂ ਵਾਲੇ ਹੈ ਇਹ ਵੀ ਠੀਕ ਹੈ ਲੋਕ ਆਪਣੇ ਅੱਗ ਬਾਲ ਕੇ ਬੈਠੇ ਰਹਿੰਦੇ ਹੈ ਵੀ ਸਾਰੇ ਗੱਲ ਬਾਤ ਕਰਦੇ ਹਾਂ ਠੀਕ ਹੈ ਇੱਥੇ ਦਾ ਮੌਸਮ ਬਹੁਤ ਬ ਬਾਰਿਸ਼ ਵੀ ਬਹੁਤ ਵਧੀਆ ਜ਼ਿਆਦਾ ਹੀ ਹੁੰਦੀ ਬਾਰਿਸ਼ ਮਤਲਬ ਕਿ ਇੱਥੇ ਇੱਥੇ ਪਹਾੜੀ ਇਲਾਕਾ ਹੈ ਨਾ ਜਿੱਥੇ ਨਦੀਆਂ ਵੀ ਬਹੁਤ ਹੈ ਸਾਡੇ ਆਲੇ ਦੁਆਲੇ ਘ ਘਰਾਂ ਵਿੱਚ ਮਤਲਬ ਲੋਕਾਂ ਦੇ ਹੜ੍ਹ ਚਲਾ ਜਾਂਦਾ ਹੈ ਥੋੜ੍ਹੇ ਲੋਕ ਜ਼ਿਆਦਾ ਪ੍ਰੇਸ਼ਾਨ ਹੋ ਜਾਂਦੇ ਹੈ ਬਸ ਇਹੀ ਹੈ ਠੀਕ ਹੈ ਹੋਰ ਤਾਂ ਮੌਸਮ ਬਹੁਤ ਵਧੀਆ ਹੈ ਇੱਥੇ ਦਾ ਹਾਂਜੀ